ਗਾਉਣਾ ਇੱਕ ਹੁਨਰ ਹੈ ਅਤੇ ਇਹ ਹੁਨਰ ਕੁਝ ਲੋਕਾਂ ਨੂੰ ਤਾਂ ਆਪਣੀ ਵਿਰਾਸਤ ਵਿੱਚ ਹੀ ਮਿਲਿਆ ਹੁੰਦਾ ਹੈ ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਕਿ ਕੁਛ ਲੋਕ ਜਿਵੇਂ ਕਿ ਇੱਕ ਬੱਚਾ ਹੈ ਅਤੇ ਉਹਦੇ ਪੇਰੈਂਟਸ ਦਾ ਕਿ ਕਿੱਦਾਂ ਮਾਤਾ ਜਾਂ ਫਿਰ ਦਾਦਾ ਦਾਦੀ ਵਿੱਚ ਕੋਈ ਵੀ ਅਗਰ ਸਿੰਗਰ ਹੈ ਤਾਂ ਉਹ ਹੁਨਰ ਬੱਚੇ ਦੇ ਵਿੱਚ ਆਟੋਮੈਟਿਕਲੀ ਆਉਣਾ ਲਾਜ਼ਮੀ ਹੈ ਅਤੇ ਅਗਰ ਬੱਚਾ ਆਪਣੇ ਹੁਨਰ ਨੂੰ ਜਲ ਸ਼ੁਰੂ ਵਿੱਚ ਹੀ ਪਹਿਚਾਣ ਲੈਂਦਾ ਹੈ ਤਾਂ ਉਸਦੇ ਲਈ ਇਹ ਬਹੁਤ ਲਾਭਕਾਰੀ ਹੁੰਦਾ ਹੈ ਤਾਂ ਜੋ ਉਹ ਵੱਡਾ ਹੋ ਕੇ ਆਪਣੇ ਹੁਨਰ ਦੇ ਲਈ ਕੁਝ ਕਰ ਪਾਵੇ ਇੱਕ ਵਧੀਆ ਸਿੰਗਰ ਬਣ ਪਾਵੇ ਅਗਰ ਕੋਈ ਸਹੀ ਸਿੰਗਰ ਬਣਨਾ ਚਾਹੁੰਦਾ ਹੈ ਤਾਂ ਮੇਰੀ ਉਸਨੂੰ ਸਿਰਫ ਇਹੀ ਸਲਾਹ ਹੈ ਕਿ ਉਹ ਕਿਸੇ ਚੰਗੇ ਉਸਤਾਦ ਕੋਲੋਂ ਸਿੱਖਿਆ ਲਵੇ ਅਤੇ ਇਲਾਚੀਆਂ ਦਾ ਸੇਵਨ ਕਰੇ ਇਲਾਚੀਆਂ ਦਾ ਸੇਵਨ ਕਰਨ ਦੇ ਨਾਲ ਗਲਾ ਬਿਲਕੁਲ ਸਾਫ ਹੁੰਦਾ ਹੈ ਅਤੇ ਆਵਾਜ਼ ਇੱਕਦਮ ਸਹੀ ਹੋ ਜਾਂਦੀ ਹੈ ਅਤੇ ਮਿਸ਼ਰੀ ਦਾ ਸੇਵਨ ਵੀ ਕਰਨਾ ਚਾਹੀਦਾ ਹੈ ਸਿੰਗਲ ਸਿੰਗਰ ਬਣਨ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਹਨ ਜਿਹਨਾਂ ਤੋਂ ਕਿ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈ ਜਿਵੇਂ ਕਿ ਸਾਨੂੰ ਆਪਣੇ ਸਰੀਰ ਵੱਲ ਧਿਆਨ ਦੇਣਾ ਚਾਹੀਦਾ ਹੈ ਸਾਨੂੰ ਫਾਸਟ ਫੂਡ ਜ਼ਿਆਦਾ ਨਹੀਂ ਖਾਣਾ ਚਾਹੀਦਾ ਕਿਉਂਕਿ ਫਾਸਟ ਫੂਡ ਫਾਸਟ ਫੂਡ ਦਾ ਸੇਵਨ ਕਰਨ ਦੇ ਨਾਲ ਸਾਡੀ ਤਬੀਅਤ ਖਰਾਬ ਹੋਣ ਦੀ ਚਾਂਸਿਸ ਰਹਿੰਦੇ ਹਨ ਅਗਰ ਸਾਡੀ ਤਬੀਅਤ ਖਰਾਬ ਹੋ ਜਾਵੇਗੀ ਤਾਂ ਇਹਦਾ ਸਿੱਧਾ ਅਸਰ ਸਾਡੇ ਗਲੇ 'ਤੇ ਪੈਂਦਾ ਹੈ ਸੋ ਇਸ ਕਰਕੇ ਮੇਰੀ ਇਹ ਸਲਾਹ ਹੈ ਕਿ ਫਾਸਟ ਫੂਡ ਨੂੰ ਛੱਡਿਆ ਜਾਵੇ ਅਤੇ ਹੈਲਦੀ ਚੀਜ਼ਾਂ ਖਾਈਆਂ ਜਾਣ ਜਿਵੇਂ ਕਿ ਸੈਲਡ ਖਾਧਾ ਜਾਵੇ ਸੈਲਡ ਖਾਣ ਦੇ ਨਾਲ ਸਾਡਾ ਪੇਟ ਇੱਕਦਮ ਸਾਫ ਰਹਿੰਦਾ ਹੈ ਅਤੇ ਸਾਡੀ ਆਵਾਜ਼ ਵਿੱਚ ਵੀ ਜਿਹੜਾ ਸਿਗਿੰਗ ਦਾ ਹੁਨਰ ਹੈ ਉਹ ਦਿਖਾਈ ਦਿੰਦਾ ਹੈ ਸਿੰਗਰ ਬਣਨਾ ਇੱਕ ਬਹੁਤ ਵੱਡੀ ਹੀ ਗੱਲ ਹੈ ਸਿੰਗਰ ਬਣਨ ਦੇ ਲਈ ਸਾਡੇ ਅੰਦਰ ਇੱਕ ਜਨੂੰਨ ਹੋਣਾ ਚਾਹੀਦਾ ਹੈ ਕਿ ਅਸੀਂ ਇਹ ਕੰਮ ਕਰਨਾ ਹੈ ਤਾਂ ਕਰਨਾ ਹੈ ਸਾਨੂੰ ਦਿਨ ਰਾਤ ਇੱਕ ਮੇ ਦਿਨ ਰਾਤ ਮਿਹਨਤ ਕਰਕੇ ਇੱਕ ਵਧੀਆ ਸਿੰਗਰ ਬਣਨਾ ਚਾਹੀਦਾ ਹੈ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਦੇ ਲਈ ਸਾਨੂੰ ਚੰਗੇ ਉਸਤਾਦ ਕੋਲੋਂ ਸਿੱਖਿਆ ਲੈਣੀ ਚਾਹੀਦੀ ਹੈ ਮੇਰੀ ਬਸ ਇਹੀ ਸਲਾਹ ਹੈ ਕਿ ਅਗਰ ਕੋਈ ਸੱਚੀ ਵਿੱਚ ਆਪਣੇ ਹੁਨਰ ਆਪਣੇ ਹੁਨਰ ਨੂੰ ਦੇਖ ਕੇ ਸਿੰਗਰ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਸਰੀਰ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਕਿਸੇ ਚੰਗੇ ਗੁਰੂ ਕੋਲੋਂ ਸਿੱਖਿਆ ਲੈਣੀ ਚਾਹੀਦੀ ਹੈ